ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਮੈਂ ਨਿਊਜ਼ ਏਟੀਨ ਤੋਂ ਬੋਲ ਰਹੀ ਹਾਂ ਅਤੇ ਮੈਂ ਤੁਹਾਡੇ ਨਾਲ ਰਿਵਰਸ ਨਾਲ ਰਿਲੇਟਡ ਗੱਲ ਕਰਨੀ ਸੀ ਵੀ ਤੁਸੀਂ ਰੀਵਰਸ ਬਾਰੇ ਦੱਸਣਾ ਸੀ ਵੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਰੀਵਰਸ ਤਿੰਨ ਆਉਂਦੀਆਂ ਨੇ ਸਤਲੁਜ ਬਿਆਸ ਅਤੇ ਰਾਵੀ ਤੁਸੀਂ

ਹਾਂਜੀ ਸਤਲੁਜ ਆਪਣੀ ਬੈਕ ਸਤਲੁਜ ਆਪਣੀ ਸਭ ਤੋਂ ਲੋਂਗੈਸਟ ਰਿਵਰ ਆ ਗਈ ਪੰਜਾਬ 'ਚ ਇਹਨੂੰ ਬੈਕਬੋਨ ਰਿਵਰ ਕਿਹਾ ਜਾਂਦਾ ਹੋਰ ਹਾਂ ਅਤੇ ਇਹਨਾਂ ਨੂੰ ਡਿਸਟਿਕਟ ਤਿੰਨ ਲੱਗਦੇ ਆ ਸਤਲੁਜ ਨੂੰ ਅਤੇ ਛੇ ਡਿਸਟਿਕਟ ਆਉਂਦੇ ਚਨਾਬ ਨੂੰ ਅਤੇ ਰਾਵੀ ਨੂੰ ਨੌਂ ਡਿਸਟਿਕਟਸ ਹਾਂ ਈਸਟ ਈਸਟ ਫਲੋਇੰਗ ਵੀ ਰਿ ਰਿਵਰਸ ਅ ਆਪਣੀਆਂ ਹਿਮਾਲਿਆ ਵਾਲੇ ਪਾਸੇ ਆ ਗਈਆਂ ਵੈਸਟ ਫਲੋਇੰਗ ਰਿਵਰਸ ਅਤੇ ਜਿਹੜੀਆਂ ਹਿਮਾਲਿਆ ਰਿਵਰ ਉਹ ਆਪਾਂ ਨੂੰ ਸਾਰਾ ਸਾਲ ਏ ਜਿਹੜਾ ਉਹ ਪਾਣੀ ਦਿੰਦੀਆਂ ਨੇ ਇਹਦੇ ਆਪਣੀ ਈਸਟ ਫਲੋਇੰਗ ਵਾਲੇ ਪਾਸੇ ਆਪਣੀ ਗੋਦਾਵਰੀ ਆ ਗਈ ਇੱਧਰੋਂ ਫਿਰ ਵੈਸਟ ਫਲੋਇੰਗ ਪਾਸੇ ਆਪਣੀ ਨਰਮਦਾ ਆ ਗਈ ਤਾਪੀ ਆ ਗਈ ਸਾਬਰਮਤੀ ਆ ਗਈ ਸਾਬਰਮਤੀ ਗੁਜਰਾਤ 'ਚ ਹੋ ਗਈ ਅਤੇ ਨਰਮਦਾ ਅਤੇ ਤਾਪੀ ਆਪਣੀ ਮਹਾਰਾਸਟਰਾ 'ਚ ਹੋਗੀ ਮੱਧਿਆ ਪ੍ਰਦੇਸ਼ 'ਚ ਗੰ ਗੰਗਾ ਵੀ ਆ ਗਈ ਆਪਣੀ ਇਹ ਗੰਗਾ ਆਪਣੀ ਗ ਆ ਗਈ ਗੋਦਾਵਰੀ ਇੱਧਰਲੇ ਪਾਸੇ ਇੰਡਸ ਫਿਰ ਗੰਗਾ ਰਿਵਰ 'ਤੇ ਉਹਦੀਆਂ ਟਰੀਬਿਊਟਰਸ ਅੱਗੋਂ ਜਾਂਦੀਆਂ ਨੇ ਆਪਣੇ ਪੰਜਾਬ ਵਾਲੇ ਪਾਸੇ ਦੀ ਹੋ ਕੇ ਹਾਂਜੀ ਬੋਲੋ ਰਿਲੇਟਿਡ ਤੁਸੀਂ ਦੋ ਅੱਗੇ ਡਿਟੇਲ ਰਿਵਰਸ ਨਾਲ ਹੋਰ